ਪੰਜਾਬੀ ਭਾਸ਼ਾ ਬਹੁਤ ਹੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਤਾਂ ਕਿ ਹਰ ਬੱਚੇ ਨੂੰ ਪੰਜਾਬੀ ਭਾਸ਼ਾ ਆਉਣੀ ਚਾਹੀਦੀ ਹੈ ਅਤੇ ਮਾਂ ਬੋਲੀ ਵੀ ਆਪਾਂ ਇਹਨੂੰ ਕਹਿ ਦਿੰਦੇ ਹਾਂ ਕਿ ਹਾਂ ਪੰਜਾਬੀ ਹੀ ਹੈ ਸਾਡੀ ਜੋ ਮਦਰ ਸਾਡੀਆਂ ਮਾਤਾ ਸਾਨੂੰ ਸਿਖਾਉਂਦੇ ਪੰਜਾਬੀ ਵਿੱਚ ਬੋਲਣਾ ਠੇਠ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਪੰਜਾਬ ਦੇ ਵਿੱਚ ਹੀ ਰਹਿ ਕੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੀਏ ਤਾਂ ਮੈਂ ਤਾਂ ਇਹੀ ਚਾਹਾਂਗਾ ਕਿ ਸਾਰੇ ਬੱਚੇ ਸਾਰੇ ਬਜ਼ੁਰਗ ਸਾਰੇ ਜਿੰਨੇ ਵੀ ਹੈ ਪੰਜਾਬੀ ਦੇ ਵਿੱਚ ਹੀ ਤੁਸੀਂ ਬੋਲੋ ਪੰਜਾਬੀ ਨੂੰ ਵੱਧ ਤੋਂ ਵੱਧ ਤੁਸੀਂ ਅੱਗੇ ਲੈ ਕੇ ਜਾਓ ਕਿ ਹਾਂ ਮੈਂ ਪੰਜਾਬ ਤੋਂ ਹਾਂ ਮੈਂ ਪੰਜਾਬੀ ਬੋਲਦਾ ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਜਦੋਂ ਤੁਸੀਂ ਇੰਟਰਵਿਊ ਦੇ ਵਿੱਚ ਜਾ ਰਹੇ ਹੋ ਤਾਂ ਉੱਥੇ ਤੁਹਾਨੂੰ ਇੰਗਲਿਸ਼ 'ਚ ਗੱਲ ਕਰਨੀ ਹੈ ਤਾਂ ਪੰਜਾਬੀ ਲੈਂਗੁਏਜ ਪੰਜਾਬੀ ਭਾਸ਼ਾ ਆਪਣੀ ਜਿਹੜੀ ਹੈ ਉਸ ਨੂੰ ਤੁਸੀਂ ਯੂਜ਼ ਕਰੋ ਵਰਤੋ ਅਤੇ ਉੱਥੇ ਇੰਟਰਵਿਊ ਦੇ ਵਿੱਚ ਵੀ ਤੁਸੀਂ ਪੰਜਾਬੀ ਯੂਜ਼ ਕਰ ਸਕਦੇ ਹੋ ਪੰਜਾਬੀ ਹਰ ਚੀਜ਼ 'ਚ ਪੰਜਾਬੀ ਹੋਣੀ ਚਾਹੀਦੀ ਆ ਅਗਰ ਕੋਈ ਆਪਦੀ ਨਾਮ ਨੰਬਰ ਪਲੇਟ ਜਾਂ ਨਾਮ ਆਪਣਾ ਪਲੇਟ ਬਣਾਉਂਦਾ ਹੈ ਤਾਂ ਉਹ ਵੀ ਪੰਜਾਬੀ 'ਚ ਹੀ ਹੋਵੇ ਤਾਂ ਕਿ ਅਸੀਂ ਪੰਜਾਬੀ ਨੂੰ ਅੱਗੇ ਲੈ ਕੇ ਜਾ ਸਕੀਏ